ਮੇਰਾ ਮਨਪਸੰਦ ਗੈਜਿਟ ਮੋਬਾਇਲ ਫੋਨ ਹੀ ਹੈ ਮੈਂ ਰੋਜ਼ਾਨਾ ਇਸ ਉੱਪਰ ਕਈ ਕਿਤਾਬਾਂ ਈ ਬੁਕਸ ਪੜ੍ਹਨ ਦੀ ਕੋਸ਼ਿਸ਼ ਕਰਦਾ ਹਾਂ ਜਦ ਵੀ ਮੇਰਾ ਸਮਾਂ ਲੱਗਦਾ ਹੈ ਔਰ ਕਿਤੇ ਵੀ ਹੋਵਾਂ ਮੈਂ ਇਸ ਤੋਂ ਕੋਈ ਵੀ ਕਿਤਾਬ ਪੜ੍ਹ ਸਕਦਾ ਹਾਂ ਹੋਰ ਵੀ ਅਗਰ ਮੈਨੂੰ ਕੋਈ ਜਾਣਕਾਰੀ ਚਾਹੀਦੀ ਹੁੰਦੀ ਹੈ ਤਾਂ ਮੈਂ ਆਪਣੇ ਫੋਨ ਤੋਂ ਕਿਸੇ ਵੀ ਸਮੇਂ ਦੇਖ ਸਕਦਾ ਹਾਂ ਅਤੇ ਜਾਣੂ ਹੋ ਸਕਦਾ ਹਾਂ ਫੋਨ ਅੱਜ ਦੇ ਸਮੇਂ ਵਿੱਚ ਸਭ ਤੋਂ ਐਡਵਾਂਸ ਟੈਕਨੋਲਜੀ ਅਤੇ ਮਨੁੱਖੀ ਜੀਵਨ ਜੀਵਨ ਸਾਥੀ ਦੇ ਰੂਪ ਵਿੱਚ ਸ਼ਾਮਲ ਹੈ ਮੈਨੂੰ ਲੱਗਦਾ ਹੈ ਕਿ ਇਸ ਦਾ ਸਹੀ ਉਪਯੋਗ ਕੀਤਾ ਜਾਣਾ ਬਹੁਤ ਲਾਜ਼ਮੀ ਹੈ ਆਉਣ ਵਾਲੀ ਜਨਰੇਸ਼ਨ ਲਈ ਸਭ ਤੋਂ ਵੱਧ ਲਾਭਦਾਇਕ ਹੋਣ ਦਾ ਸਥਾਨ ਪ੍ਰਾਪਤ ਕਰਨ ਦੇ ਕਾਬਲ ਹੋਵੇਗਾ